ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਫਕੀਰਾਂ ਅਤੇ ਮੁਰੀਦਾਂ ਦੀ ਧਰਤੀ ਹੈ ਇਸ ਖਿੱਤੇ ਵਿੱਚ ਰਹਿਣ ਵਾਲੇ ਲੋਕ ਆਪਣੇ ਆਪਣੇ ਧਰਮ ਵਿੱਚ ਆਸਥਾ ਰੱਖਦੇ ਹਨ ਪਰ ਕੁਝ ਕੁ ਤਿਉਹਾਰ ਸਾਂਝੇ ਤੌਰ 'ਤੇ ਮਨਾਏ ਜਾਂਦੇ ਹਨ ਵੱਖ ਵੱਖ ਗੁਰੂ ਸਾਹਿਬਾਨਾਂ ਦੇ ਗੁਰਪੁਰਬ ਸ਼ਹੀਦੀ ਦਿਹਾੜੇ ਸਾਰੇ ਸੰਸਾਰ ਵਿੱਚ ਜਿੱਥੇ ਵੀ ਨਾਨਕ ਨਾਮ ਲੇਵਾ ਸ਼ਰਧਾਲੂ ਵੱਸਦੇ ਹਨ ਉਹ ਆਪਣੇ ਆਪਣੇ ਅਕੀਦੇ ਅਨੁਸਾਰ ਇਹਨਾਂ ਨੂੰ ਬੜੇ ਸ਼ਰਧਾ ਨਾਲ ਅਤੇ ਪਿਆਰ ਨਾਲ ਮਨਾਉਂਦੇ ਹਨ ਸੱਭਿਆਚਾਰਕ ਮੇਲੇ ਵੀ ਪੰਜਾਬੀਆਂ ਦੀ ਰੂਹ ਦੀ ਖੁਰਾਕ ਹਨ ਬਹੁਤ ਸਾਰੇ ਖੇਡ ਮੇਲੇ ਹਨ ਜੋ ਹਰ ਸਾਲ ਵੱਖੋ ਵੱਖਰੇ ਪਿੰਡਾਂ ਸ਼ਹਿਰਾਂ ਵਿੱਚ ਮਨਾਏ ਜਾਂਦੇ ਹਨ ਇਹਨਾਂ ਖੇਡ ਮੇਲਿਆਂ ਵਿੱਚ ਖਿਡਾਰੀ ਆਪਣੀ ਖੇਡ ਦਾ ਅਤੇ ਕਲਾਕਾਰ ਆਪਣੀ ਕਲਾ ਦਾ ਮੁਜ਼ਾਹਰਾ ਕਰਦੇ ਹਨ ਇਹ ਖੇਡ ਮੇਲੇ ਸਾਨੂੰ ਭਾਈਚਾਰਕ ਸਾਂਝ ਅਤੇ ਮਿਲਵਰਤਨ ਦੀ ਭਾਵਨਾ ਪੈਦਾ ਕਰਦੇ ਹਨ ਇਨ੍ਹਾਂ ਖੇਡ ਮੇਲਿਆਂ ਵਿੱਚ ਧਾਰਮਿਕ ਅਤੇ ਰਾਜਨੀਤਿਕ ਲੋਕ ਵੀ ਹਾਜ਼ਰੀ ਭਰਦੇ ਹਨ ਅਤੇ ਨੇ ਅਤੇ ਆਪਣੀ ਆਪਣੀ ਗੱਲ ਇਹਨਾਂ ਖੇਡ ਮੇਲਿਆਂ ਵਿੱਚ ਅਤੇ ਇਹਨਾਂ ਗੁਰਪੁਰਬਾਂ ਵਿੱਚ ਆਪਣੇ ਸਾਹਮਣੇ ਰੱਖਦੇ ਹਨ